ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਸੁਪਰਡੈਂਟ ਆ ਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਪਣੇ ਪੰ ਹਾਂਜੀ ਆਪਣੇ ਕੋਲ ਪੰਜਾਬ 'ਚ ਫਿਲਹਾਲ ਤਾਂ ਅ ਸਮਝੋ ਵੀ ਸਤਲੁਜ ਬਿਆਸ ਅਤੇ ਰਾਵੀ ਆ ਰਾਵੀ ਪਾਕਿਸਤਾਨ ਦੇ ਵਿੱਚ ਵਾਂਗੂ ਹੀ ਹੈ ਜ਼ਿਆਦਾ ਪੰਜਾਬ 'ਚ ਘੱਟ ਹੈਗਾ ਉਹਦਾ ਸਤਲੁਜ ਜ਼ਿਆਦਾ ਸਤਲੁਜ ਐਂ ਸਮਝੋ ਪੰਜਾਬ ਦਾ ਸੱ ਪੰਜਾਹ ਤੋਂ ਸੱਠ ਪ੍ਰਸੈਂਟ ਏਰੀਆ ਕਵਰ ਕਰ ਜਾਂਦਾ ਇਹ ਸਮਝ ਲਓ ਵੀ ਇਹ ਰਕਬਾ ਕਰਦਾ ਗਾ ਸੱਤਰ ਪ੍ਰਸੈਂਟ ਦੇ ਕਰੀਬ ਰਕਬਾ ਇਹ ਕਵਰ ਕਰ ਜਾਂਦਾ ਹੈਗਾ ਕਈ ਨਹਿਰਾਂ ਇਹਦੇ ਵਿੱਚ ਦੀ ਨਿਕਲੀਆਂ ਗਈਆਂ ਕੱਢੀਆਂ ਗਈਆਂ

ਇਹਨੂੰ ਮ ਇਹ ਉਹਦੇ ਅੰਡਰ ਆਉਂਦਾ ਜੀ ਚਾਲੀ ਕੁ ਪ੍ਰਸੈਂਟ ਅਤੇ ਬਾਕੀ ਐਂਟਰੀ ਆ ਜਿਹੜੀ ਇਜੈਕਟ ਆ ਉਹ ਸਾਨੂੰ ਡਿਪਾਰਟਮੈਂਟ ਵੱਲੋਂ ਬਾਅਦ 'ਚ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ

ਹਾਂਜੀ ਹਾਂਜੀ ਉਹ ਸਾਨੂੰ ਦੱਸਦਾ ਵੀ ਕਿਹੜੇ ਡੈਮ 'ਤੇ ਕਿੰਨੀ ਬਿਜਲੀ ਪੈਦਾ ਕੀਤੀ ਜਾ ਰਹੀ ਆ ਕਿਹੜੀ ਥਾਂ 'ਤੇ ਕਿਹੜਾ ਡੈਮ ਲੱਗਿਆ ਹੋਇਆ ਹੈਗਾ ਜਾਂ ਕਿਹੜੀ ਨਹਿਰ ਕਿਹੜੇ ਦਰਿਆ 'ਚੋਂ ਕੱਢ ਕੇ ਅੱਗੇ ਭੇਜੀ ਗਈ ਆ ਅਤੇ ਉਸ ਨਹਿਰ 'ਤੇ ਵੀ ਕਿੰਨੀ ਬਿਜਲੀ ਪੈਦਾ ਕੀਤੀ ਗਈ ਹੈ ਇਹ ਸਾਨੂੰ ਅਲੱਗ ਅਲੱਗ ਹਾਂਜੀ ਉਹਦੇ ਵਿੱਚ ਇਹ ਹੈ ਜੀ ਅਸੀਂ ਹਰ ਰੋਜ਼ ਦੇ ਹਿਸਾਬ ਨਾਲ ਹੁੰਦਾ ਹੈਗਾ ਇਜੈਕਟ ਫਿਗਰ ਨਹੀਂ ਹੁੰਦੀ ਕਦੇ ਘੱਟ ਜਾਂਦਾ ਕਦੇ ਵੱਧ ਭੇਜਣਾ ਪੈਂਦਾ ਗਾ ਉਹ ਮੂਹਰਲੀ ਡਿਮਾਂਡ 'ਤੇ ਨਿਰਭਰ ਕਰਦਾ ਗਾ ਹਾਂ ਉਹ ਸਾਨੂੰ ਮਿਨੀਮਮ ਮੈਕਸੀਮਮ ਜਿੰਨਾ ਹੁੰਦਾ ਹੈਗਾ ਉਹਦੇ ਵਿੱਚੋਂ ਕੱਢ ਕੇ ਦੱਸ ਦਾਂਗੇ ਤੁਹਾਨੂੰ ਐਵਰੇਜ ਹਾਂਜੀ ਦਫ਼ਤਰ ਆ ਜਿਓ ਤੁਸੀਂ ਕੋਈ ਨਹੀਂ ਤੁਹਾਨੂੰ ਬੰਦਾ ਦੇ ਦਾਂਗੇ ਨਾਲ ਗੱਲਬਾਤ ਕਰ ਲਿਓ ਤੁਸੀਂ ਉਹਨਾਂ ਨਾਲ ਸਾਡੇ ਇੱਕ ਇਸ ਵਿਭਾਗ ਲਈ ਅਲੱਗ ਸਾਡਾ ਇੱਕ ਰੱਖਿਆ ਹੋਇਆ ਹੈਗਾ ਮੁਲਾਜ਼ਮ ਉਹ ਸਾਰੀਆਂ ਜਿਹੜੀਆਂ ਇਨਫੋਰਮੇਸ਼ਨ ਆ ਉਹ ਸਾਰੀਆਂ ਉਹਨਾਂ ਕੋਲ ਹੁੰਦੀਆਂ ਠੀਕ ਹੈ ਓਕੇ ਓਕੇ ਜੀ ਓਕੇ